ਹੈਲੋ ਹਾਂਜੀ ਤੁਸੀਂ ਗੋਪਾਲ ਸਵੀਟਸ ਤੋਂ ਬੋਲ ਰਹੇ ਹੋ ਹਾਂਜੀ ਅਸੀਂ ਔਡਰ ਕੀਤਾ ਸੀ ਇੱਕ ਲੰਚ ਦਾ ਬਾਰਾਂ ਵਜੇ ਅਤੇ ਇੱਕ ਵਜੇ ਡਿਲੀਵਰੀ ਟਾਈਮ ਦੱਸਿਆ ਸੀ ਤੁਸੀਂ ਪਰ ਹੁਣ ਤਿੰਨ ਵੱਜ ਚੁੱਕੇ ਨੇ ਔਲਰੇਡੀ ਦੋ ਘੰਟੇ ਜਿਹੜੇ ਲੇਟ ਹੈ ਅਤੇ ਅਜੇ ਤੱਕ ਸਾਡੇ ਕੋਲ ਲੰਚ ਜਿਹੜਾ ਪਹੁੰਚਿਆ ਨਹੀਂ ਹੈਗਾ ਅੱਛਾ ਜੀ ਚੱਲਿਆ ਹੋਇਆ ਤੁਹਾਡਾ ਜਿਹੜਾ ਇਪਲਾਈ ਹੈ ਚਲੋ ਅਸੀਂ ਪੰਦਰਾਂ ਕੁ ਮਿੰਟ ਤੱਕ ਹੋਰ ਵੇਟ ਕਰ ਲੈਂਦੇ ਹਾਂ ਉਸ ਤੋਂ ਬਾਅਦ ਨਹੀਂ ਫਿਰ ਅਸੀਂ ਜਿਹੜਾ ਹੈਗਾ ਔਡਰ ਹੈ ਉਹ ਕੈਂਸਲ ਕਰ ਦਿਆਂਗੇ ਹਾਂਜੀ ਵੇਟ ਕਰ ਲੈਂਦੇ ਹਾਂ ਥੋੜ੍ਹਾ ਚਿਰ ਹੋਰ